ਹਾਂਜੀ ਭਾਅ ਜੀ ਮੋਨੂ ਕੁਲਚੇ ਵਾਲਿਆਂ ਤੋਂ ਬੋਲ ਰਹੇ ਹੋ ਭਾਅ ਜੀ ਮੈਂ ਹੁਣੇ ਤੁਹਾਡੇ ਕੁਲਚੇ ਆਡਰ ਕੀਤੇ ਨੇ ਅਤੇ ਮੈਂ ਉਹਦੀ ਪੇਮੈਂਟ ਵੀ ਕਰ ਦਿੱਤੀ ਹੈ ਅਤੇ ਮੈਂ ਬਸ ਇਹੋ ਪੁੱਛਣਾ ਸੀ ਕੀ ਉਹਦੀ ਪੇਮੈਂਟ ਤੁਹਾਨੂੰ ਪ੍ਰਾਪਤ ਹੋ ਗਈ ਹੈ ਕਿਉਂਕਿ ਇੱਥੋਂ ਕੱਟ ਗਈ ਹੋਈ ਹੈ ਪਰ ਮੇਰੇ ਪੋਰਟਲ 'ਤੇ ਸ਼ੋਅ ਨਹੀਂ ਹੋ ਰਿਹਾ ਦੇਖ ਕੇ ਦੱਸ ਦਿਓ ਦੱਸਿਓ ਫਿਰ ਮੈਨੂੰ ਇੱਕ ਮਿੰਟ ਹਾਂਜੀ ਹੋ ਗਈ ਹੈ ਤੁਹਾਨੂੰ ਸਫ਼ਲ ਚਲੋ ਠੀਕ ਹੈ ਭਾਅ ਜੀ ਫਿਰ ਤੁਸੀਂ ਨਾ ਉਹ ਡਿਲੀਵਰੀ ਕਰਵਾ ਦਿਓ ਫਿਰ ਮੇਰੇ ਕੁਲਚਿਆਂ ਦੀ ਅਤੇ ਜਲਦੀ ਕਰਾ ਦਿਓ ਮੈਂ ਜਰਾ ਕਿਤੇ ਬਾਅਦ 'ਚ ਜਾਣਾ ਵੀ ਜੇ ਜਰਾ ਕੰਮ 'ਤੇ ਜਲਦੀ ਭੇਜ ਦੇਵੋ ਫਿਰ ਅਤੇ ਡਿਲੀਵਰੀ ਪਾਰਟਨਰ ਨੂੰ ਜਰਾ ਜਲਦੀ ਕੋਂਟੈਕਟ ਕਰ ਲਓ ਉਹਨੂੰ ਕਹਾ ਕੇ ਮੈਨੂੰ ਫੜਾ ਜਾਵੇ